ਤੇਲ ਵਾਲ਼ੇ ਬਰਤਨਾਂ ਨੂੰ ਸਾਫ ਕਰਨੀ ਅਲੱਗ ਅਲੱਗ ਤਰੀਕੇ ਵਰਤੇ ਜਾਂਦੇ ਹਨ ਇਸ ਪੁਰਾਣੇ ਸਮਿਆਂ ਵਿੱਚ ਲੋਕ ਤੇਲ ਵਾਲ਼ੇ ਬਰਤਨਾਂ ਨੂੰ ਮਿੱਟੀ ਦੇ ਨਾਲ਼ ਧੋਂਦੇ ਸੀ ਸਵਾਹ ਨਾਲ਼ ਵੀ ਧੋਂਦੇ ਸੀ ਜਿਉਂ ਜਿਉਂ ਟਾਈਮ ਬਦਲਦਾ ਗਿਆ ਉਸ ਟਾਈਮ ਹੁਣ ਲੋਕ ਨਵੇਂ ਨਵੇਂ ਤਰੀਕੇ ਕੈਮੀਕਲ ਯੂਸ ਕਰਦੇ ਕੈਮੀਕਲ ਯੂਸ ਕਰਦੇ ਨੇ ਜਿਵੇਂ ਕਿ ਡਿਸ਼ਵੋਸ਼ ਨਾਲ਼ ਚੰਗੀ ਤਰ੍ਹਾਂ ਧੋਤਾ ਜਾ ਸਕਦਾ ਹੈ ਧੋ ਧੋ ਭਾਂਡੇ ਨੂੰ ਧੋਇਆ ਜਾ ਸਕਦਾ ਹੈ